ਹਾਂਜੀ ਭਾਅ ਜੀ ਤੁਹਾਡੇ ਕੋਲ ਯੂ ਪੀ ਆਈ ਹੋਵੇਗਾ ਹਾਂਜੀ ਜੀ ਮੇਰੇ ਤੋਂ ਨਾ ਕੈਸ਼ ਨਹੀਂ ਹੈਗਾ ਹਾਂਜੀ ਉਹ ਮੈਨੂੰ ਲੱਗਦਾ ਹੈ ਕਿ ਮੇਰਾ ਸ਼ਾਇਦ ਜਿਹੜਾ ਪਰਸ ਸੀ ਪੈਸੇ ਤਾਂ ਮੇਰੇ ਤੋਂ ਹੈਗੇ ਸੀ ਪਰ ਮੈਨੂੰ ਲੱਗਦਾ ਕਿ ਮੇਰਾ ਪਰਸ ਜਿਹੜਾ ਨਾ ਉਹ ਮੈਂ ਘਰ ਹੀ ਛੱਡ ਆਈ ਹੋਈ ਹਾਂ ਅਤੇ ਸਾਰਾ ਕੈਸ਼ ਉਹਦੇ ਵਿੱਚ ਸੀ ਹਾਂਜੀ ਅਤੇ ਜੇ ਤੁਹਾਡੇ ਕੋਲ ਯੂ ਪੀ ਆਈ ਹੈਗਾ ਹੈ ਤਾਂ ਮੈਂ ਤੁਹਾਨੂੰ ਉਹ 'ਤੇ ਕਰ ਦਿੰਦੀ ਹਾਂ ਹਾਂ ਕਿਉਂਕਿ ਹੁਣ ਮੇਰੇ ਤੋਂ ਇਸ ਟਾਈਮ ਬਸ ਫੋਨ ਹੀ ਹੈਗਾ ਆ ਅਤੇ ਉਹਦੇ ਵਿੱਚ ਹੀ ਪੈਸੇ ਹੈਗੇ ਆ ਅਤੇ ਤੁਹਾਨੂੰ ਪਤਾ ਹੁਣ ਆਪਣੇ ਜਗ੍ਹਾ 'ਤੇ ਪਹੁੰਚ ਗਈ ਹਾਂ ਤੁਸੀਂ ਵੀ ਅੱਗੋਂ ਜਾਣਾ ਆ ਅਤੇ ਹੁਣ ਬਸ ਇਹੋ ਇੱਕ ਰਸਤਾ ਹੈਗਾ ਤੁਹਾਡੇ ਪੈਸੇ ਦੇਣ ਦਾ ਹਾਂਜੀ ਤੁਸੀਂ ਮੈਨੂੰ ਆਪਣਾ ਦੱਸ ਦਿਉ ਫੋਨ ਨੰਬਰ ਜਾਂ ਫਿਰ ਅਕਾਊਂਟ ਨੰਬਰ ਜਾਂ ਸਕੈਨਰ ਦੇ ਦਿਉ ਮੈਂ ਉਹ 'ਤੇ ਤੁਹਾਨੂੰ ਭੁਗਤਾਨ ਕਰ ਦਿੰਦੀ ਹਾਂ ਹਾਂ ਮੈਂ ਉੱਥੋਂ ਖੰਡਵਾਲੇ ਤੋਂ ਚੜ੍ਹੀ ਸੀ ਅਤੇ ਮੈਂ ਹਾਂ ਇੱਥੇ ਸਟੇਸ਼ਨ ਲਾਗੇ ਉੱਤਰੀ ਹਾਂ ਹਾਂਜੀ ਅਤੇ ਉਹਦੇ ਤੁਸੀਂ ਦੱਸ ਦਿਉ ਕਿੰਨੇ ਪੈਸੇ ਬਣਦੇ ਆ ਅਤੇ ਮੈਂ ਤੁਹਾਨੂੰ ਓਨੇ ਸਕੈਨ ਕਰਕੇ ਦੇ ਦਿੰਦੀ ਹਾਂ ਹਾਂਜੀ ਬੋਲੋ ਅੱਛਾ ਹਾਂਜੀ ਹਾਂਜੀ ਅੱਛਾ ਠੀਕ ਹੈ ਹਾਂਜੀ ਹਾਂਜੀ ਇਹੀ ਨੰਬਰ ਨਾ ਇੱਕ ਵਾਰ ਫਿਰ ਵੇਖ ਲਉ ਤੁਸੀਂ ਹਾਂਜੀ ਹਾਂ ਦੇਖੋ ਮੈਂ ਜ਼ਰਾ ਕੁ ਤੁਹਾਨੂੰ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਆ ਕਿ ਨਹੀਂ ਆਏ ਆ ਗਏ ਆ ਚਲੋ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ